ਪੱਚੀ ਜਨਵਰੀ ਉੱਨੀ ਪਚਾਨਵੇਂ ਤੀਹ ਫਰਵਰੀ ਉੱਨੀ ਸਤਾਨਵੇਂ ਦਸ ਮਈ ਵੀਹ ਦਸ ਪੱਚੀ ਅਪ੍ਰੈਲ ਵੀਹ ਪੰਦਰਾਂ ਸਤਾਰਾਂ ਦਸੰਬਰ ਵੀਹ ਬਾਈ